ਮੈਂ ਸ਼ੇਅਰ ਮਾਰਕੀਟ ਬਾਰੇ ਜ਼ਿਆਦਾ ਤਾਂ ਨਹੀਂ ਜਾਣਦੀ ਪਰ ਮੈਨੂੰ ਇੰਨਾ ਜ਼ਰੂਰ ਪਤਾ ਹੈ ਕਿ ਲੋਕ ਇਸਨੂੰ ਲੈ ਕੇ ਬਹੁਤ ਜ਼ਿਆਦਾ ਉਤਸੁਕ ਹੁੰਦੇ ਹਨ ਕਿ ਉਹ ਆਪਣਾ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਖਰੀਦ ਸਕਣ ਅਤੇ ਉਹ ਕੋਸ਼ਿਸ਼ ਕਰਦੇ ਹਨ ਕਿ ਉਹ ਸ਼ੇਅਰ ਉੱਦੋਂ ਖਰੀਦਣ ਜਦੋਂ ਇਹਨਾਂ ਦਾ ਰੇਟ ਬਿਲਕੁਲ ਗਿਰਿਆ ਹੋਇਆ ਹੋਵੇ ਅਤੇ ਜਦੋਂ ਉਹ ਇਸ ਦਾ ਰੇਟ ਵਧ ਜਾਂਦਾ ਹੈ ਤਾਂ ਉਹ ਇਹਨਾਂ ਨੂੰ ਹੋਰ ਲੋਕਾਂ ਨੂੰ ਵੇਚ ਦਿੰਦੇ ਹਨ ਜਿੱਥੋਂ ਕਿ ਉਹਨਾਂ ਨੂੰ ਫਾਇਦਾ ਹੁੰਦਾ ਹੈ ਅਤੇ ਉਹ ਆਪਣੀ ਇਨਵੈਸਟਮੈਂਟ ਤੋਂ ਲਾਭ ਲੈ ਸਕਦੇ ਹਨ ਮੇਰੇ ਅਨੁਸਾਰ ਡਿਜ਼ੀਟਲ ਐਪਸ ਨੇ ਭਾਰਤ ਵਿੱਚ ਵਪਾਰ ਨੂੰ ਚੰਗੀ ਬਹੁਤ ਚੰਗੀ ਤਰ੍ਹਾਂ ਬਦਲ ਦਿੱਤਾ ਹੈ ਅਤੇ ਲੋਕ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਔਨਲਾਈਨ ਲੈ ਸ ਲੈ ਰਹੇ ਹਨ ਅਤੇ ਵਪਾਰ ਵੀ ਔਨਲਾਈਨ ਹੀ ਹੋ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੀ ਲੋੜ ਨਹੀਂ ਪੈ ਰਹੀ ਮੇਰੇ ਅਨੁਸਾਰ ਇਹ ਚੀਜ਼ ਉਦੋਂ ਖਤਰਨਾਕ ਹੈ ਜਦੋਂ ਆਪਾਂ ਇਸ ਆਪਾਂ ਬਿਨਾਂ ਕਿਸੇ ਚੰਗੇ ਮਸ਼ਵਰੇ ਤੋਂ ਇਸਨੂੰ ਸ਼ੁਰੂ ਕਰ ਦਿੰਦੇ ਹਾਂ ਅਤੇ ਲੋਕ ਇਸ ਦਾ ਗਲਤ ਫਾਇਦਾ ਚੱਕਣਾ ਸ਼ੁਰੂ ਕਰ ਦਿੰਦੇ ਹਨ